ਚੌਦਾਂ ਫਰਵਰੀ ਉੱਨੀ ਸੌ ਅਠਾਨਵੇਂ ਇੱਕ ਜਨਵਰੀ ਦੋ ਹਜ਼ਾਰ ਇੱਕ ਪੰਦਰਾਂ ਮਈ ਦੋ ਹਜ਼ਾਰ ਸੱਤ ਤਿੰਨ ਮਾਰਚ ਦੋ ਹਜ਼ਾਰ ਤੇਰਾਂ ਅਤੇ ਚੌਵੀ ਜਨਵਰੀ ਉੱਨੀ ਸੌ ਅਠਾਨਵੇਂ